ਅੱਜ ਦੇ ਟਾਈਮ ਵਿੱਚ ਵਿਗਿਆਪਨ ਦੇਣਾ ਜਾਂ ਲੋਕਾਂ ਤੱਕ ਪਹੁੰਚਣਾ ਕੋਈ ਬਹੁਤਾ ਮੁਸ਼ਕਿਲ ਨਹੀਂ ਰਿਹਾ ਜਿਵੇਂ ਗਲੋਬਲਾਈਜੇਸ਼ਨ ਦੇ ਕਰਕੇ ਆਪਾਂ ਇੱਕ ਦੂਸਰੇ ਨਾਲ ਵਧੇਰੇ ਟੱਚ ਵਿੱਚ ਰਹਿਣ ਲੱਗੇ ਹਾਂ ਇਵੇਂ ਹੀ ਆਵਾਜਾਈ ਦੇ ਸਾਧਨ ਕੁਝ ਇੰਨੇ ਕੁ ਤੇਜ਼ ਹੋ ਗਏ ਹਨ ਕਿ ਆਪਾਂ ਇੱਕ ਦੂਸਰੇ ਤੱਕ ਪਹੁੰਚਣਾ ਕੋਈ ਬਹੁਤ ਲੰਬਾ ਟਾਈਮ ਨਹੀਂ ਲਾਉਂਦਾ ਅਤੇ ਬਹੁਤਾ ਔਖਾ ਵੀ ਨਹੀਂ ਰਿਹਾ ਜੇ ਆਪਾਂ ਵਿਗਿਆਪਨ ਦੀ ਗੱਲ ਕਰੀਏ ਤਾਂ ਵਿਗਿਆਪਨ ਸੋਸ਼ਲ ਮੀਡੀਆ ਤੋਂ ਵਧੀਆ ਕੋਈ ਵੀ ਸੋਰਸ ਨਹੀਂ ਹੋ ਸਕਦਾ ਸੋਸ਼ਲ ਮੀਡੀਆ 'ਤੇ ਇੰਸਟਾਗ੍ਰਾਮ ਫੇਸਬੁੱਕ ਯੂਟੀਊਬ ਜਾਂ ਫਿਰ ਕੁਝ ਹੋਰ ਤਰੀਕੇ ਹਨ ਪੈਫਲੇਟ ਬਣਾ ਕੇ ਆਪਾਂ ਅਖਬਾਰਾਂ ਦੇ ਵਿੱਚ ਵੰਡ ਸਕਦੇ ਹਾਂ ਇਸ ਤਰੀਕੇ ਨਾਲ ਵਿਗਿਆਪਨ ਦੇਣੇ ਬਹੁਤ ਸੌਖੇ ਹੋ ਜਾਂਦੇ ਨੇ ਤੇ ਲੋਕਾਂ ਨੂੰ ਬਹੁਤ ਜਲਦੀ ਪ੍ਰਭਾਵਿਤ ਵੀ ਕਰਦੇ ਹਨ ਲੋਕਾਂ ਤੱਕ ਪਹੁੰਚਣਾ ਬਹੁਤ ਸੌਖਾ ਹੋ ਗਿਆ ਲੋਕਾਂ ਨੂੰ ਆਪਾਂ ਆਪਣੀ ਗੱਲ ਕਿਸੇ ਵਧੀਆ ਅਟਰੈਕਟਿਵ ਜੇ ਪੈਫਲੇਟ ਨਾਲ ਜਾਂ ਅਟਰੈਕਟਿਵ ਕੋਈ ਫਲੈਕਸ ਲਾ ਦਿੱਤੀ ਗਲੀ ਮੁਹੱਲੇ ਦੇ ਵਿੱਚ ਓ ਉਹਦੇ ਨਾਲ ਵੀ ਆਪਾਂ ਲੋਕਾਂ ਤੱਕ ਪਹੁੰਚ ਸਕਦੇ ਹਾਂ ਜੇ ਮੈਂ ਗੱਲ ਕਰਾਂ ਕਿ ਮੈਨੂੰ ਕੋਈ ਇਸ਼ਤਿਹਾਰ ਵਧੀਆ ਲੱਗਿਆ ਤਾਂ ਇੱਕ ਕੋਈ ਮੈਂ ਕੋਲਜ ਤੋਂ ਇੱਕ ਵਾਰ ਬਾਹਰ ਨਿਕਲ ਰਹੀ ਸੀ ਤਾਂ ਕੋਈ ਨਾ ਐਵੇਂ ਹੀ ਸੁੱਟੀ ਜਾ ਰਿਹਾ ਸੀਗਾ ਮੈਨੂੰ ਲੱਗਿਆ ਕੋਈ ਇਨਵੈਲਪ ਹੈ ਪਰ ਜਦੋਂ ਇਨਵੈਲਪ ਮੈਂ ਥੋੜ੍ਹਾ ਜਿਹਾ ਚੁੱਕ ਕੇ ਵੇਖਿਆ ਉਹ ਅਸਲ ਦੇ ਵਿੱਚ ਕੋਈ ਇਨਵੈਲਪ ਨਹੀਂ ਸੀਗਾ ਮੈਨੂੰ ਐਵੇਂ ਲੱਗਿਆ ਵੀ ਕਿਸੇ ਦਾ ਕੰਮ ਦਾ ਕੋਈ ਡਿੱਗ ਗਿਆ ਉਹ ਅਸਲ ਦੇ ਵਿੱਚ ਇੱਕ ਪੈਫਲੇਟ ਸੀ ਐਡਵਰਟਾਈਜ਼ਮੈਂਟ ਇੰਨੀ ਕੁ ਵਧੀਆ ਸੀ ਕਿ ਧੱਕੇ ਨਾਲ ਦਿਲ ਕਰ ਰਿਹਾ ਸੀ ਕਿ ਉਹਨੂੰ ਪੜ੍ਹਿਆ ਜਾਵੇ ਜਦੋਂ ਮੈਂ ਉਹ ਪੜ੍ਹਿਆ ਤਾਂ ਉਹ ਇੱਕ ਕੋਚਿੰਗ ਸੈਂਟਰ ਦਾ ਪੈਫਲੇਟ ਸੀ ਜਿੱਥੇ ਪਲੱਸ ਵੰਨ ਟੂ ਦੇ ਸਾਇੰਸ ਦੇ ਵਿਦਿਆਰਥੀਆਂ ਨੂੰ ਕੋਚਿੰਗ ਦਿੱਤੀ ਜਾਂਦੀ ਸੀ ਅਤੇ ਮੈਂ ਆਪਣੇ ਕਜ਼ਨ ਨੂੰ ਉਹਦੇ ਬਾਰੇ ਦੱਸਿਆ ਜੋ ਪਲੱਸ ਟੂ ਦੇ ਵਿੱਚ ਪੜ੍ਹਦਾ ਸੀ ਅਤੇ ਉਹਨੂੰ ਪੈਫਲੇਟ ਦਿਖਾਇਆ ਤਾਂ ਉਹ ਵੀ ਬਹੁਤ ਪ੍ਰਭਾਵਿਤ ਹੋਇਆ ਕਿਉਂਕਿ ਉਹਦੇ ਵਿੱਚ ਜਿਹੜੇ ਉਹਦੇ ਸ਼ਬਦਾਵਲੀ ਸੀ ਬਹੁਤ ਸੋਹਣੀ ਸੀ ਅਤੇ ਜਿਹੜੇ ਅੱਖਰ ਸੀਗੇ ਉਹ ਵੀ ਥੋੜ੍ਹੇ ਬੁਲੇਟ ਦੇ ਵਿੱਚ ਮੋਟੇ ਕਰਕੇ ਲਿਖੇ ਹੋਏ ਸੀਗੇ ਤਾਂ ਉਸ ਚੀਜ਼ ਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ ਅਤੇ ਮੇਰੇ ਅੱਜ ਵੀ ਯਾਦ ਹੈ ਅਤੇ ਵੀ ਉਹ ਧੱਕੇ ਨਾਲ ਹੀ ਮੈਂ ਉਸਨੂੰ ਪੜ੍ਹਨ ਲਈ ਮਜਬੂਰ ਹੋ ਗਈ ਕਿਉਂਕਿ ਉਹਦੀ ਰਚਨਾ ਇੰਨੀ ਹੀ ਪ੍ਰਭਾਵਸ਼ਾਲੀ ਸੀਗੀ